ਜਿਵੇਂ ਕਿ ਮੈਂ ਇੱਕ ਟੀਚਰ ਹਾਂ ਹੋਮ ਟਿਊਟਰ ਹਾਂ ਅਤੇ ਮਤਲਬ ਮੈਨੂੰ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਇਹ ਚੀਜ਼ ਮੈਨੂੰ ਬਹੁਤ ਖੁਸ਼ੀ ਦਿੰਦੀ ਆ ਮਤਲਬ ਜੋ ਪਿਆਰ ਕਰਦੇ ਹੈ ਬਿਲਕੁਲ ਇੰਨੇ ਇਨੋਸੈਂਟ ਹੁੰਦੇ ਆ ਛੋਟੇ ਬੱਚੇ ਅਤੇ ਮਤਲਬ ਬਿਲਕੁਲ ਭੁੱਲਣ ਵਾਲੇ ਹੁੰਦੇ ਵੀ ਅੱਜ ਅਗਰ ਤੁਸੀਂ ਉਹਨਾਂ ਨੂੰ ਡਾਂਟ ਵੀ ਦਿੱਤਾ ਤਾਂ ਇੱਦਾਂ ਨਹੀਂ ਹੈ ਵੀ ਕੱਲ੍ਹ ਨੂੰ ਉਹ ਤੁਹਾਡੀ ਇਹ ਗੱਲ ਯਾਦ ਰੱਖਣਗੇ ਕੱਲ੍ਹ ਨੂੰ ਜਾਵਾਂਗੀ ਫਿਰ ਦੁਬਾਰਾ ਮੈਨੂੰ ਜੱਫੀ ਪਾ ਕੇ ਮਿਲਣਗੇ ਇਹ ਚੀਜ਼ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਦਿੰਦੀ ਹੈ ਵੀ ਉਹਨਾਂ ਦਾ ਭੋਲਾਪਣ ਹੈ ਨਾ ਛੋਟੇ ਜਿਹੜੇ ਬੱਚੇ ਹੁੰਦੇ ਆ ਬਹੁਤ ਪਿਆਰੇ ਹੁੰਦੇ ਆ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਇਹ ਚੀਜ਼ ਦਿੰਦੀ ਆ ਵੀ ਮੈਂ ਉਹਨਾਂ ਨੂੰ ਸਭ ਤੋਂ ਬੈਸਟ ਐਜੂਕੇਸ਼ਨ ਦੇ ਸਕਾਂ ਅਤੇ ਜਦੋਂ ਮੈਨੂੰ ਪਿਆਰ ਦਿੰਦੇ ਹੈ ਹੈ ਨਾ ਵੀ ਬੈਕ ਪਿਆਰ ਮਿਲਦਾ ਹੈ ਤਾਂ ਬਹੁਤ ਜ਼ਿਆਦਾ ਮੈਨੂੰ ਅੱਛਾ ਲੱਗਦਾ ਹੈ ਦੂਸਰੀ ਚੀਜ਼ ਮੈਨੂੰ ਖੁਸ਼ੀ ਦਿੰਦੀ ਹੈ ਵੀ ਮੈਂ ਸੇਵਾ ਕਰਦੀ ਹਾਂ ਜਦੋਂ ਸੇਵਾ ਮੈਂ ਕਿਸੇ ਦੀ ਵੀ ਕਰਾਂ ਕਿਸੇ ਇਨਸਾਨ ਦੀ ਪੇਰੈਂਟਸ ਦੀ ਡੋਗਸ ਦੀ ਸਪੈਸ਼ਲੀ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦੀ ਹੈ ਮਤਲਬ ਮੈਨੂੰ ਇੱਦਾਂ ਲੱਗਦਾ ਹੈ ਵੀ ਮੈਨੂੰ ਸਾਰਾ ਕੁਛ ਹਾਸਲ ਕਰ ਲਿਆ ਜਦੋਂ ਮੈਂ ਸੇਵਾ ਕੀਤੀ ਗੁਰੂ ਘਰ ਸੇਵਾ ਕੀਤੀ ਜਾਂ ਫਿਰ ਮੈਂ ਕਿਸੇ ਵੀ ਜੋ ਨੀਡੀ ਹੈ ਉਸਦੀ ਮਦਦ ਕੀਤੀ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਹੈ ਉਸ ਦੀ ਮਦਦ ਕੀਤੀ ਉਹ ਵੀ ਚੀਜ਼ ਮੈਨੂੰ ਬਹੁਤ ਖੁਸ਼ੀ ਦਿੰਦੀ ਹੈ ਮਤਲਬ ਇਹ ਛੋਟੀ ਛੋਟੀ ਚੀਜ਼ਾਂ ਜਦੋਂ ਇੱਕਦਮ ਕੁਲੈਕਟ ਹੋ ਜਾਂਦੀਆਂ ਯਾਦ ਕਰਦੇ ਹਾਂ ਨਾ ਤਾਂ ਫਿਰ ਕਾਫੀ ਜ਼ਿਆਦਾ ਖੁਸ਼ੀ ਮਿਲਦੀ ਹੈ ਮਤਲਬ ਮੈਨੂੰ ਇਹ ਦੋ ਚੀਜ਼ਾਂ ਤੋਂ ਇੱਕ ਉਹ ਛੋਟੇ ਬੱਚਿਆਂ ਨੂੰ ਪੜ੍ਹਾਉਣ ਨਾਲ ਜੋ ਉਹਨਾਂ ਤੋਂ ਪਿਆਰ ਮਿਲਦਾ ਹੈ ਦੂਜਾ ਕਿਸੇ ਦੀ ਸੇਵਾ ਕਰਨ ਨਾਲ ਧੰਨਵਾਦ ਜੀ